ਹੈਲੋ ਤੁਸੀਂ ਮਹਾਂਜਨ ਕਿਤਾਬਾਂ ਦੀ ਦੁਕਾਨ ਤੋਂ ਗੱਲ ਕਰ ਰਹੇ ਹੋ ਮੈਂ ਨਾ ਪਿਛਲੇ ਸਾਲ ਵੀ ਤੁਹਾਡੇ ਤੋਂ ਸੈਕਿੰਡ ਈਅਰ ਦੀਆਂ ਕਿਤਾਬਾਂ ਲਿੱਤੀਆਂ ਸੀਗੀਆਂ ਉਹ ਬਹੁਤ ਵਧੀਆ ਸੀਗੀਆਂ ਅਤੇ ਮੈਂ ਹੁਣ ਫਾਈਨਲ ਈਅਰ ਦੀਆਂ ਲੈਣੀਆਂ ਹੈ ਤੁਹਾਡੇ ਤੋਂ ਅਤੇ ਉਹ ਮੈਂ ਹੁਣ ਤੁਹਾਨੂੰ ਸੈਕਿੰਡ ਈਅਰ ਦਾ ਸੈੱਟ ਪੁਰਾਣਾ ਵਾਲਾ ਆਪਣਾ ਦੇ ਦੂੰਗੀ ਉਹ ਬਿਲਕੁਲ ਸਾਫ ਹੈ ਉਹਦੇ ਪੇਜਿਸ ਬਿਲਕੁਲ ਸਾਫ ਨੇ ਕੋਈ ਮਤਲਬ ਹੈ ਨਹੀਂ ਠੀਕ ਹੈ ਮਤਲਬ ਬਿਲਕੁਲ ਸੈੱਟ ਉਹ ਉਹ ਮੈਂ ਤੁਹਾਨੂੰ ਦੇ ਦੂੰਗੀ ਪੁਰਾਣਾ ਅਤੇ ਨਵੇਂ ਵਾਲਾ ਲੈ ਲੈਣਾ ਹੈ ਤੁਹਾਡੇ ਤੋਂ ਉਹ ਮਿਲ ਜੂਗਾ ਪੰਜਾਬ ਯੂਨੀਵਰਸਿਟੀ ਹੈ ਜੀ ਬੀ ਏ ਮੈਨੂੰ ਬੀ ਏ ਫਾਈਨਲ ਈਅਰ ਦੀਆਂ ਕਿਤਾਬਾਂ ਚਾਹੀਦੀਆਂ ਅਤੇ ਮੇਰੇ ਕੋਲ ਨੋਟਸ ਵੀ ਹੈਗੇ ਆ ਮੇਰੇ ਉਹ ਵੀ ਤੁਸੀਂ ਰੱਖ ਲਵੋਂਗੇ ਹਾਂਜੀ ਹਾਂਜੀ ਅਤੇ ਮੇਰੇ ਕੋਲ ਕੁਸ਼ਚਨ ਪੇਪਰਸ ਵੀ ਹੈ ਉਹ ਵੀ ਰੱਖ ਲਵੋਂਗੇ ਬੁੱਕਸ ਦੇ ਨਾਲ ਹੀ ਅਤੇ ਮੈਂ ਆਪਣੇ ਬ੍ਰਦਰ ਭਾਈ ਲਈ ਬੁੱਕਸ ਲੈਣੀਆਂ ਨੇ ਟੈਨਥ ਦੀਆਂ ਉਹ ਵੀ ਤੁਹਾਡੇ ਤੋਂ ਮਿਲ ਜਾਣਗੀਆਂ ਨਿਊ ਐਡੀਸ਼ਨਸ ਦੀਆਂ ਉਹਨਾਂ ਦਾ ਸੀ ਬੀ ਐੱਸ ਈ ਬੋਰਡ ਹੈ ਜੀ ਹਾਂਜੀ ਅਤੇ ਮੈਂ ਨਿਊ ਸੈੱਟ ਜਿਹੜਾ ਲੈਣਾ ਹੈ ਉਹਦੇ ਮੈਨੂੰ ਕਿੰਨੇ ਪੈਸੇ ਵਿੱਚ ਪਾਉਣੇ ਪੈਣਗੇ ਠੀਕ ਹੈ ਮੈਮ ਆਪਾਂ ਦੁਕਾਨ 'ਤੇ ਆ ਕੇ ਗੱਲ ਕਰ ਲਵਾਂਗੇ ਮੈਂ ਕੱਲ੍ਹ ਆ ਜੂੰਗੀ ਠੀਕ ਹੈ ਜੀ